ਹੈਲੋ ਹਾਂਜੀ ਵੀਰ ਜੀ ਤੁਸੀਂ ਇਸ ਸਮੇਂ ਰੀਜੋਟ ਤੋਂ ਬੋਲ ਰਹੇ ਹੋ ਵੀਰ ਜੀ ਮੈਂ ਪੀਜ਼ੇ ਔਡਰ ਕਰੇ ਸੀਗੇ ਅਜੇ ਪੀਜ਼ਾ ਘਰ ਨਹੀਂ ਆਇਆ ਜੀ ਅਤੇ ਮੈਂ ਕਦੋਂ ਦੀ ਵੇਟ ਕਰ ਰਹੀ ਹਾਂ ਘਰ ਗੈਸਟ ਆਏ ਹੋਏ ਨੇ ਤੁਸੀਂ ਜਿਸ ਤਰ੍ਹਾਂ ਮਰਜ਼ੀ ਕਰਕੇ ਵੀਰ ਜੀ ਪੀਜ਼ਾ ਆਪਣਾ ਭੇਜੋ ਗੈਸਟ ਘਰ ਬੈਠੇ ਅਸੀਂ ਕਦੋਂ ਦੇ ਵੇਟ ਕਰ ਰਹੇ ਹਾਂ ਪੀਜ਼ੇ ਦੀ ਦੇਖੋ ਤੁਸੀਂ ਐਡਰੈੱਸ ਵਗੈਰਾ ਸਹੀ ਦਿੱਤਾ ਉਹਨਾਂ ਨੂੰ ਕਿ ਨਹੀਂ ਤੁਸੀਂ ਇਕ ਵਾਰ ਕਾਲ ਕਰਕੇ ਪੁੱਛੋ ਕਿ ਆ ਰਿਹਾ ਆ ਨਹੀਂ ਆ ਰਿਹਾ ਭਾਅ ਜੀ ਅਸੀਂ ਕਦੋਂ ਦੇ ਵੇਟ ਕਰ ਰਹੇ ਹਾਂ ਪੰਜ ਪੀਜ਼ੇ ਔਡਰ ਕਰੇ ਸੀਗੇ ਜੀ ਸਹੀ ਟਾਈਮ 'ਤੇ ਪਹੁੰਚਾ ਦਿਉ ਭਾਅ ਜੀ ਇਹ ਟਾਈਮ ਕਾਫ਼ੀ ਲੱਗ ਗਿਆ ਮੈਂ ਦੋ ਤਿੰਨ ਵਾਰ ਕਾਲ ਕਰ ਚੁੱਕੀ ਤੁਹਾਨੂੰ ਕਿ ਪਤਾ ਕਰੋ ਤੁਸੀਂ ਕਿਉਂ ਨਹੀਂ ਪਹੁੰਚਿਆ ਠੀਕ ਹੈ